ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਮੇਰੀ ਨੌਕਰੀ ਦੀ ਪੋਸਟ ਦਿੱਲੀ ਨਿਕਲੀ ਸੀ ਅਤੇ ਮੇਰੇ ਘਰ ਦੇ ਪੁਰਾਣੀ ਸੋਚ ਵਾਲੇ ਸਨ ਉਹ ਕਹਿੰਦੇ ਸਨ ਕਿ ਅਸੀਂ ਕੁੜੀ ਨੂੰ ਐਡੀ ਦੂਰ ਨਹੀਂ ਭੇਜਣਾ ਪਰ ਮੈਂ ਚਾਹੁੰਦੀ ਸੀ ਕਿ ਮੈਂ ਦਿੱਲੀ ਜਾ ਕੇ ਇਸ ਨੌਕਰੀ ਨੂੰ ਕਰਾਂ ਪਰ ਮੇਰੇ ਘਰਦਿਆਂ ਖਿਲਾਫ਼ ਜਾ ਕੇ ਮੈਂ ਇਸ ਨੌਕਰੀ ਨੂੰ ਨਹੀਂ ਕਰ ਸਕਦੀ ਸੀ ਇਸ ਲਈ ਮੈਂ ਆਪਣੀ ਪੱਕੀ ਸਹੇਲੀ ਨਵ ਨੂੰ ਆਪਣੀ ਨੌਕਰੀ ਬਾਰੇ ਦੱਸਿਆ ਅਤੇ ਆਪਣੇ ਪਰਿਵਾਰ ਦੀ ਪੁਰਾਣੀ ਸੋਚ ਬਾਰੇ ਦੱਸਿਆ ਉਸ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਆਪਣੇ ਘਰਦਿਆਂ ਨੂੰ ਉਹਨਾਂ ਕੁੜੀਆਂ ਦੇ ਬਾਰੇ ਦੱਸ ਜੋ ਪੜ੍ਹ ਲਿਖ ਕੇ ਚੰਗੇ ਮੁਕਾਮ 'ਤੇ ਪਹੁੰਚ ਗਈਆਂ ਸਨ ਉਹਨਾਂ ਦੀ ਉਦਾਹਰਨ ਦੇ ਅਤੇ ਨੌਕਰੀ ਨੂੰ ਕਰ ਇਸ ਲਈ ਮੈਨੂੰ ਇਸ ਫੈਸਲੇ ਨੂੰ ਲੈਣਾ ਮੇਰੇ ਭਵਿੱਖ ਲਈ ਬਹੁਤ ਜ਼ਰੂਰੀ ਸੀ ਇਹ ਫੈਸਲਾ ਮੇਰੇ ਲਈ ਬਹੁਤ ਮਹੱਤਵਪੂਰਨ ਸੀ